ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੇਰੇ ਨਾਲ ਕਰ ਰਿਹਾ ਸੀ ਗੱਲ ਹਾਂਜੀ ਦੱਸੋ ਮੈਨੂੰ ਨਾ ਤੁਹਾਡਾ ਪ੍ਰੋਸੀਜਰ ਕੀ ਹੈਗਾ ਬਈ ਕਦੋਂ ਜਾਣਾ ਹੈ ਕਿੱਥੇ ਸਟੇਅ ਕਰਨਾ ਹੈ ਅਤੇ ਕੀ ਤੁਹਾਡਾ ਆਉਣ ਜਾਣ ਦਾ ਕੀ ਹੈਗਾ ਹੈ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਅੱਛਾ ਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਅਤੇ ਕਿਹੜੀ ਜਗ੍ਹਾ ਲੈ ਕੇ ਜਾ ਰਹੇ ਬੱਚੇ ਨੂੰ ਮਨਾਲੀ ਅਤੇ ਕਿੰਨੇ ਦਿਨ ਦਾ ਟ੍ਰਿਪ ਹੈਗਾ ਤੁਹਾਡਾ ਇਹ ਅਤੇ ਕਿੰਨਾ ਖਰਚਾ ਟੋਟਲ ਅੱਛਾ ਜੀ ਅੱਠ ਹਜ਼ਾਰ ਰੁਪਇਆ ਟੋਟਲ ਖਰਚਾ ਇਹਦਾ ਆਏਗਾ ਅਤੇ ਤੁਸੀਂ ਤਿੰਨ ਦਿਨ ਦਾ ਸਟੇਅ ਕਿਹਾ ਹੈ ਨਾ ਅਤੇ ਦਸ ਤਰੀਕ ਤੁਸੀਂ ਚੱਲੋਗੇ ਅਤੇ ਵਾਪਸ ਤੁਸੀਂ ਆਓਗੇ ਤੇਰ੍ਹਾਂ ਨੂੰ ਵਾਪਸ ਆਓਗੇ ਠੀਕ ਹੈ ਜੀ ਅਤੇ ਬਾਕੀ ਕਲਾਸ ਜਿਵੇਂ ਮਤਲਬ ਬਾਕੀ ਸਿਰਫ ਇਹਨਾਂ ਦੀ ਕਲਾਸ ਜਾ ਰਹੀ ਹੈ ਜਾਂ ਬਾਕੀ ਬੱਚੇ ਵੀ ਜਾ ਰਹੇ ਨੇ ਹੋਰ ਸਕੂਲ ਦੇ ਬੱਚੇ ਠੀਕ ਹੈ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਫੇਰ ਇੱਦਾਂ ਕਰੋ ਕਿ ਕਰ ਲਓ ਅਤੇ ਮੈਂ ਉਹਨੂੰ ਭੇਜ ਦੇਵਾਂਗਾ ਜੀ ਮੈਂ ਤੁਹਾਨੂੰ ਫੀਸ ਪੇਅ ਕਰ ਦਾਂਗਾ ਓਕੇ ਓਕੇ ਜੀ ਓਕੇ